ਮੈਂ ਕਈ ਵਾਰ ਖਾਣਾ ਬਣਾਉਣ ਦੇ ਮੁਕਾਬਲੇ ਵਿੱਚ ਹਿੱਸਾ ਲਿਆ ਹੈ ਮੈਨੂੰ ਖਾਣਾ ਬਣਾਉਣਾ ਬਹੁਤ ਪਸੰਦ ਹੈ ਅਤੇ ਮੈਂ ਖਾਣਾ ਬਣਾਉਣਾ ਸ਼ ਸ਼ੁਰੂ ਸੋਲ੍ਹਾਂ ਸਾਲ ਦੀ ਉਮਰ ਤੋਂ ਹੀ ਸ਼ੁਰੂ ਕਰ ਦਿੱਤਾ ਸੀਗਾ ਅਤੇ ਮੇਰੇ ਸਾਰੀ ਫੈਮਲੀ ਨੂੰ ਮੇਰੇ ਹੱਥਾਂ ਦਾ ਖਾਣਾ ਖਾਣਾ ਬਹੁਤ ਵਧੀਆ ਲੱਗਦਾ ਹੈ ਅਤੇ ਉਹ ਮੇਰੀ ਬਹੁਤ ਤਾਰੀਫ ਵੀ ਕਰਦੇ ਹਨ ਅਤੇ ਮੇਰਾ ਇੱਕ ਯੂਟੂਬ ਵੀ ਯੂਟਿਊਬ ਚੈਨਲ ਵੀ ਹੈ ਜਿਸ 'ਤੇ ਮੈਂ ਹਰ ਰੋਜ਼ ਵੀਡੀਓ ਪਾਉਂਦੀ ਹਾਂ ਕਿਉਂਕਿ ਮੇਰੇ ਫਰੈਂਡਸ ਨੂੰ ਮੇਰਾ ਖਾਣੇ ਦੀ ਵਿਧੀ ਬਹੁਤ ਵਧੀਆ ਲੱਗਦੀ ਹੈ ਅਤੇ ਉਹ ਮੈਨੂੰ ਬਹੁਤ ਕਮੈਂਟਸ ਵਗੈਰਾ ਦਿੰਦੇ ਹਨ ਜਿਵੇਂ ਕਿ ਉਹ ਕਹਿੰਦੇ ਹਨ ਕਿ ਤੁਸੀਂ ਇੱਕ ਵੀਡੀਓ ਨਾ ਪਾਏ ਕਰੋ ਕਿਉਂ ਅ ਹਰ ਰੋਜ਼ ਦੋ ਤਿੰਨ ਵੀਡੀਓ ਪਾਏ ਕਰੋ ਕਿਉਂਕਿ ਅਸੀਂ ਤੁਹਾਡੀ ਵੀਡੀਓਜ਼ ਦੇਖ ਕੇ ਬਹੁਤ ਕੁਛ ਸਿੱਖਦੇ ਹਾਂ